ਗੱਤਕਾ ਆਮ ਤੌਰ 'ਤੇ ਕੇਸਰੀ ਅਤੇ ਨੀਲੇ ਰੰਗ ਦਾ ਹੀ ਪਾਇਆ ਜਾਂਦਾ ਹੈ ਅਤੇ ਉੱਤੇ ਖੰਡੇ ਚੱਕਰ ਆਦਿ ਦੀ ਵਰਤੋਂ ਕੀਚ ਕੀਤੀ ਜਾਂਦੀ ਹੈ ਸ਼੍ਰੀ ਸਾਹਿਬ ਆਦਿ ਵੀ ਸਜਾਇਆ ਜਾਂਦਾ ਹੈ ਇਹ ਆਮ ਤੌਰ 'ਤੇ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਆਤਮ ਰਖਸ਼ਾ ਲਈ ਆਪਣੀ ਰਕਸ਼ਾ ਲਈ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇਹ ਜ਼ੁਲਮਾਂ ਦੀ ਲੜਾਈ ਦੇ ਖਿਲਾਫ਼ ਇੱਕ ਫੌਜ ਦੇ ਰੂਪ ਵਿੱਚ ਸੰਗਠਿਤ ਹੋਈ ਅਤੇ ਅੱਤਿਆਚਾਰ ਦਾ ਇਹਨਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ ਅਤੇ ਆਪਣੀ ਸ ਸੁਰਕਸ਼ਾ ਲਈ ਇਹਨਾਂ ਨੇ ਜ਼ੁਲਮਾਂ ਨਾਲ ਟਾਕਰਾ ਲਿਆ ਗੱਤਕਾ ਇੱਕ ਸਿੱਖ ਧਰਮ ਵਿੱਚ ਇੱਕ ਆਪਣੀ ਰਕਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਮਾਰਸ਼ਲ ਆਰਟ ਹੈ ਜੋ ਆਪਣੀ ਰਕਸ਼ਾ ਲਈ ਅਤੇ ਦੂਜਿਆਂ ਦੀ ਰਕਸ਼ਾ ਲਈ ਇਹ ਵਰਤਿਆ ਜਾਂਦਾ ਹੈ ਹੁਣ ਇਹ ਗੱਕਤਾ ਇੰਡੀਅਨ ਲੈਵਲ 'ਤੇ ਵੀ ਖੇਡਿਆ ਜਾਂਦਾ ਹੈ ਅਤੇ ਇਹ ਇੱਕ ਫੌਜ ਦਾ ਵੀ ਪ੍ਰਤੀਕ ਹੈ ਜਦੋਂ ਮੁਗਲਾਂ ਦਾ ਅੱਤਿਆਚਾਰ ਬਹੁਤ ਜ਼ਿਆਦਾ ਵੱਧ ਚੁੱਕਾ ਸੀਗਾ ਤਾਂ ਸਿੱਖ ਕੇਸਰੀ ਅਤੇ ਨੀਲੇ ਬਾਣੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਦੁਸ਼ਮਣਾਂ ਦੇ ਖਿਲਾਫ਼ ਲੜਾਈ ਕੀਤੀ ਅਤੇ ਜਿਹਦੇ ਵਿੱਚ ਗੱਤਕਾ ਜਿਹੜਾ ਹੈਗਾ ਉਹ ਮੁੱਖ ਖੇਡਿਆ ਜਾਂਦਾ ਹੈ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਹਥਿਆਰ ਵਰਤੇ ਜਾਂਦੇ ਹਨ ਜਿਵੇਂ ਲਾਠੀ ਨਾਲ ਤਲਵਾਰ ਨਾਲ ਕਿਰਪਾਨ ਨਾਲ ਅਤੇ ਹੋਰ ਵੀ ਇੱਕ ਚੱਕਰ ਵਰਤਿਆ ਜਾਂਦਾ ਹੈ ਗੱਤਕਾ ਸਿੱਖ ਆਪਣੀ ਹਿਫਾਜ਼ਤ ਲਈ ਹਰ ਕਿਸੇ ਸਿੱਖ ਨੂੰ ਸਿੱਖਣਾ ਇਹ ਜ਼ਰੂਰੀ ਹੁੰਦਾ ਸੀ ਤਾਂ ਕਿ ਉਹ ਆਪਣੀ ਹਿਫਾਜ਼ਤ ਕਰ ਸਕੇ ਅਤੇ ਲੋਕਾਂ ਦੀ ਹਿਫਾਜ਼ਤ ਵੀ ਕਰ ਸਕੇ ਤੇ ਇਹਦੇ ਵਿੱਚ ਸਾਰੇ ਸਿੱਖ ਧਰਮ ਜਦੋਂ ਇੱਕ ਬਾਣਾ ਕੇਸਰੀ ਜਾਂ ਨੀਲਾ ਪਹਿਨਦੇ ਹਨ ਉਹ ਇੱਕ ਤਰ੍ਹਾਂ ਦੇ ਹੀ ਇੱਕ ਫੌਜ ਦਾ ਪ੍ਰਤੀਕ ਹੈ